ਮੈਨੂੰ ਪੰਛੀਆਂ ਨਾਲ ਬਹੁਤ ਪਿਆਰ ਹੈ ਦਿਨ ਵੇਲੇ ਤਾਂ ਮੈਂ ਬਹੁਤ ਜ਼ਿਆਦਾ ਪੰਛੀ ਦੇਖੇ ਜਿਵੇਂ ਸਵੇਰੇ ਉਠਦਿਆਂ ਹੀ ਪੰਛੀਆਂ ਦੀਆਂ ਉਡਾਰਾਂ ਇਧਰ ਉਧਰ ਦੇਖਣ ਨੂੰ ਮਿਲਦੀਆਂ ਅਤੇ ਮੰਨ ਨੂੰ ਬਹੁਤ ਆਨੰਦ ਮਿਲਦਾ ਹੈ ਅਤੇ ਮੈਨੂੰ ਬਹੁਤ ਚੰਗਾ ਲੱਗਦਾ ਹੈ ਇਸ ਤਰ੍ਹਾਂ ਮੈਂ ਮਤਲਬ ਬਹੁਤ ਵਧੀਆ ਲੱਗਿਆ ਇਸ ਤਰ੍ਹਾਂ ਆਪਾਂ ਪੰਛੀ ਸ਼ਾਮੀ ਘਰਾਂ ਵਿੱਚ ਵੀ ਵਰਤਦੇ ਦੇਖਦੇ ਹਾਂ ਤਾਂ ਬਹੁਤ ਚੰਗਾ ਲੱਗਦਾ ਹੈ ਜਦੋਂ ਇੱਕ ਵਾਰ ਵਿੱਚ ਹੀ ਕਿੰਨੇ ਪੰਛੀਆਂ ਦੀਆਂ ਉਡਾਰਾਂ ਇਧਰ ਉਧਰ ਜਾਣ ਨੂੰ ਮਿਲਦੀਆਂ ਹਨ ਜਦੋਂ ਉਹ ਆਪਣੇ ਆਲਣਿਆਂ ਨੂੰ ਘਰ ਵਾਪਸ ਜਾਂਦੇ ਹਨ ਤਾਂ ਰਾਤ ਪੈਣ 'ਤੇ ਵੀ ਆਪਾਂ ਕਈ ਤਰ੍ਹਾਂ ਦੇ ਪੰਛੀਆਂ ਨੂੰ ਦੇਖਦੇ ਹਾਂ ਜਿਵੇਂ ਕਿ ਉੱਲੂ ਚਮਗਾਦੜ ਇਹ ਪੰਛੀਆਂ ਨੂੰ ਆਪਾਂ ਰਾਤ ਨੂੰ ਦੇਖਦੇ ਹਾਂ ਜ਼ਿਆਦਾਤਰ ਤਾਂ ਇਹ ਪੰਛੀ ਕਦੀ ਕਦੀ ਦੇਖਣ ਨੂੰ ਮਿਲਦੇ ਹਨ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਹੈ ਮੈਨੂੰ ਵੈਸੇ ਵੀ ਪੰਛੀ ਬਹੁਤ ਵਧੀਆ ਲੱਗਦੇ ਹਨ ਪੰਛੀਆਂ ਨੂੰ ਦੇਖ ਕੇ ਉਹਨਾਂ ਦੀ ਆਵਾਜ਼ਾਂ ਨੂੰ ਸੁਣ ਕੇ ਅਲੱਗ ਹੀ ਮਨ ਨੂੰ ਆਨੰਦ ਮਿਲਦਾ ਹੈ ਮੈਨੂੰ ਪੰਛੀਆਂ ਨਾਲ ਬਹੁਤ ਪਿਆਰ ਹੈ